ਹਾਂਜੀ ਪੰਜਾਬ ਦਾ ਜੋ ਸੱਭਿਆਚਾਰ ਹੈ ਬਹੁਤ ਹੀ ਅਮੀਰ ਅਤੇ ਪ੍ਰਭਾਵਸ਼ਾਲੀ ਹੈ ਇੱਥੋਂ ਦੇ ਲੋਕ ਬਹੁਤ ਹੀ ਵਧੀਆ ਸੁਭਾਅ ਦੇ ਮਾਲਕ ਨੇ ਪੰਜਾਬੀ ਲੋਕ ਵੱਖ ਵੱਖ ਮੌਕਿਆਂ ਉੱਤੇ ਵੱਖ ਵੱਖ ਕੱਪੜੇ ਅਤੇ ਗਹਿਣਿਆਂ ਦੀ ਵਰਤੋਂ ਕਰਦੇ ਨੇ ਜਿਵੇਂ ਕਿ ਆਦਮੀ ਜ਼ਿਆਦਾਤਰ ਕੁੜਤੇ ਅਤੇ ਪਜ਼ਾਮੇ ਦੀ ਵਰਤੋਂ ਕਰਦੇ ਹਨ ਸਿੱਖ ਪਰਿਵਾਰਿਕ ਆਦਮੀ ਨੇ ਉਹ ਆਪਣੇ ਸਿਰ ਦੇ ਉੱਪਰ ਪੱਗਾਂ ਦੀ ਵਰਤੋਂ ਕਰਦੇ ਨੇ ਪ੍ਰੰਤੂ ਜਿਵੇਂ ਜਿਵੇਂ ਸਮਾਂ ਬਦਲਦਾ ਜਾ ਰਿਹਾ ਹੈ ਉਸੇ ਤਰ੍ਹਾਂ ਉਹਨਾਂ ਦੇ ਕੱਪੜੇ ਅਤੇ ਗਹਿਣਿਆਂ ਦੇ ਵਿੱਚ ਵੀ ਬਦਲਾਅ ਦੇਖਣ ਨੂੰ ਮਿਲ ਰਿਹਾ ਵਿਆਹ ਸ਼ਾਦੀ ਦੌਰਾਨ ਉਹ ਪੈਂਟ ਕੋਟ ਅਤੇ ਟਾਈ ਦੀ ਵਰਤੋਂ ਵੀ ਅੱਜ ਕੱਲ੍ਹ ਕਰਨ ਲੱਗ ਪਏ ਹਨ ਵੱਖ ਵੱਖ ਗਹਿਣਿਆਂ ਦੀ ਵਰਤੋਂ ਵੀ ਕੀਤੀ ਜਾਂਦੀ ਹੈ ਗੱਭਰੂ ਨੇ ਜੋ ਕਿ ਆਮ ਕਰਕੇ ਗਲਾਂ ਵਿੱਚ ਕੈਂਠਿਆਂ ਦੀ ਵਰਤੋਂ ਵੀ ਕਰਦੇ ਸਨ ਉਹ ਅੱਜ ਕੱਲ੍ਹ ਚੈਨੀਆਂ ਦੀ ਵਰਤੋਂ ਵੀ ਕਰਨ ਲੱਗ ਪਏ ਹਨ ਕੁਝ ਸ਼ੌਕੀਨ ਗੱਭਰੂ ਕੰਨਾਂ ਵਿੱਚ ਨੱਤੀਆਂ ਦੀ ਵਰਤੋਂ ਵੀ ਕਰਦੇ ਨੇ ਇਸੇ ਤਰ੍ਹਾਂ ਜੇ ਮੈਂ ਔਰਤਾਂ ਬਾਰੇ ਗੱਲ ਕਰਾਂ ਤਾਂ ਜ਼ਿਆਦਾਤਰ ਔਰਤਾਂ ਸੂਟ ਸਲਵਾਰ ਅਤੇ ਦੁਪੱਟੇ ਦੀ ਵਰਤੋਂ ਕਰਦੀਆਂ ਨੇ ਪ੍ਰੰਤੂ ਸਮੇਂ ਦੇ ਬਦਲਣ ਕਾਰਨ ਉਹਨਾਂ ਦੇ ਪਹਿਰਾਵੇ ਵਿੱਚ ਵੀ ਬਹੁਤ ਫਰਕ ਵੇਖਣ ਨੂੰ ਮਿਲ ਰਿਹਾ ਗਹਿਣਿਆਂ ਵਿੱਚ ਉਹ ਕੰਨਾਂ ਵਿੱਚ ਵਾਲੀਆਂ ਕਾਂਟੇ ਅਤੇ ਹੱਥਾਂ ਵਿੱਚ ਸੋਨੇ ਦੀਆਂ ਮੁੰਦਰੀਆਂ ਦੀ ਵਰਤੋਂ ਕਰਦੀਆਂ ਹਨ ਇਸ ਤੋਂ ਬਿਨਾਂ ਅਲੱਗ ਅਲੱਗ ਤਿਉਹਾਰਾਂ ਅਤੇ ਮੌਕਿਆਂ 'ਤੇ ਉਹਨਾਂ ਦੇ ਪਹਿਰਾਵੇ ਅਤੇ ਗਹਿਣੇ ਵੱਖਰੇ ਵੱਖਰੇ ਹੁੰਦੇ ਹਨ ਇਸ ਤੋਂ ਬਿਨਾਂ ਫੁਲਕਾਰੀ ਵੀ ਪੰਜਾਬ ਵਿੱਚ ਬਹੁਤ ਪ੍ਰਚੱਲਿਤ ਹੈ ਜੋ ਕਿ ਵਿਆਹੀ ਹੋਈ ਮੁਟਾ ਮੁਟਿਆਰ ਦਾ ਸ਼ਿੰਗਾਰ ਹੈ ਇਸ ਤੋਂ ਬਿਨਾਂ ਸਾਡੇ ਖੇਤਰ ਵਿੱਚ ਵੀ ਜੇ ਮੈਂ ਦੂਜਿਆਂ ਦੇ ਖੇਤਰ ਦੀ ਗੱਲ ਕਰਾਂ ਤਾਂ ਇਹ ਪਹਿਰਾਵੇ ਵੱਖਰੇ ਹੋ ਸਕਦੇ ਨੇ ਜਿਵੇਂ ਕਈ ਖੇਤਰਾਂ ਵਿੱਚ ਲੋਕ ਮਾਵੇ ਵਾਲੀ ਪੱਗ ਦੀ ਵਰਤੋਂ ਕਰਦੇ ਹਨ ਅਤੇ ਦੂਜੇ ਖੇਤਰਾਂ ਦੇ ਵਿੱਚ ਉਹ ਬਿਨਾਂ ਮਾਵੇ ਤੋਂ ਵਰਤੋਂ ਕਰਦੇ ਹਨ ਪੱਗ ਦੀ ਅਤੇ ਕਈ ਖੇਤਰਾਂ ਦੇ ਵਿੱਚ ਨੋਕਾਂ ਵਾਲੀ ਜੁੱਤੀ ਬਹੁਤ ਪ੍ਰਚਲਿਤ ਹੈ ਅਤੇ ਦੂਜੇ ਖੇਤਰਾਂ ਵਿੱਚ ਉਹ ਇਹ ਜੁੱਤੀ ਪ੍ਰਚਲਿਤ ਨਹੀਂ ਹੈ ਧੰਨਵਾਦ